ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਪ੍ਰੀਤ ਕੌਰ ਹੈ ਮੈਂ ਤੁਹਾਡੇ ਜੱਗੀ ਸਵੀਟਸ ਦੀ ਦੁਕਾਨ ਤੋਂ ਆਪਣਾ ਔਡਰ ਦਿੱਤਾ ਸੀ ਔਡਰ ਵਿੱਚ ਨਿਊਡਲ ਬਰਗਰ ਪਾਸਤਾ ਸੀ ਜੋ ਕਿ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਮਿਲਿਆ ਹੈ ਇਸ ਦੀ ਪੈਕਜਿੰਗ ਬਹੁਤ ਵਧੀਆ ਸੀ ਅਤੇ ਖਾਣਾ ਵੀ ਅੰਦਰੋਂ ਫਰੈੱਸ਼ ਅਤੇ ਗਰਮ ਸੀ ਮੇਰੇ ਘਰ ਰਿਸ਼ਤੇਦਾਰ ਆਏ ਹੋਏ ਸਨ ਉਹਨਾਂ ਨੂੰ ਇਹ ਖਾਣਾ ਖਾ ਕੇ ਬੜਾ ਚੰਗਾ ਲੱਗਿਆ ਅਤੇ ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਮਿਲੀ ਮੈਨੂੰ ਇਹ ਸਭ ਕੁਝ ਵੇਖ ਕੇ ਬੜਾ ਚੰਗਾ ਲੱਗਿਆ ਮੈਂ ਅੱਗੇ ਤੋਂ ਵੀ ਤੁਹਾਡੇ ਕੋਲ ਔਡਰ ਕਰਦੀ ਰਹਾਂਗੀ ਧੰਨਵਾਦ